ਸਾਡੇ ਜਾਣੀ ਕਿ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਜਾਣੀ ਕਿ ਬਹੁਤ ਜ਼ਿਆਦਾ ਮਸ਼ਹੂਰ ਹੈ ਪਰ ਜਦ ਮਰਜ਼ੀ ਸਾਡੇ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਜਦ ਮਰਜ਼ੀ ਦੇਖ ਲਉ ਘਰ 'ਚ ਤਾਂ ਇਹ ਚੀਜ਼ ਮਿਲਣ ਹੀ ਮਿਲਣੀ ਹੈ ਮੱ ਲੱਸੀ ਮੱਖਣ ਮੱਕੀ ਦੀ ਰੋਟੀ ਜਾਣੀ ਕਿ ਆਮ ਤੌਰ 'ਤੇ ਸਾਡੇ ਹਰ ਇੱਕ ਪਿੰਡ 'ਚ ਮਿਲੇਗੀ ਮਿਲੇਗੀ ਆਲੇ ਦੁਆਲੇ ਜਿੱਦਾਂ ਸਾਡੇ ਕੋਲ ਪਿੰਡ 'ਚ ਸ਼ਹਿਰ 'ਚ ਬਾਹਰ ਢਾਬੇ ਹੁੰਦੇ ਢਾਬਿਆਂ ਪਰ ਵੀ ਬਹੁਤ ਜ਼ਿਆਦਾ ਵਧੀਆ ਉੱਥੇ ਜ਼ਰੂਰ ਸਾਨੂੰ ਮਿਲਦੀ ਅਤੇ ਚੀਜ਼ ਮਿਲਣੀ ਮਿਲਣੀ ਹੈ ਜਾਣੀ ਕਿ ਜਦ ਦਿਲ ਕਰਿਆ ਸਾਗ ਖੇਤਾਂ ਵਿੱਚੋਂ ਤੋੜ ਲਿਆਏ ਆ ਕੇ ਬਣਾ ਤਾ ਮੱਕੀ ਆ ਮੱਕੀ ਦੀ ਰੋਟੀ ਜਾਣੀ ਕਿ ਸਭ ਤੋਂ ਜ਼ਿਆਦੀ ਆਪਣੇ ਆਲਮੋਸਟ ਮੇਰੇ ਹਿਸਾਬ ਨਾਲ ਸਭ ਤੋਂ ਆਪਣੇ ਪੰਜਾਬ 'ਚ ਸਰਸੋਂ ਕਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਲੋਕ ਬਹੁਤ ਵਧੀਆ ਢੰਗ ਨਾਲ ਸਵਾਦ ਨਾਲ ਖਾਂਦੇ ਹੈ